ਡਾਂਸਿੰਗ ਕਰੀਅਰ ਨੂੰ ਅੱਗੇ ਵਧਾਉਣਾ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਇੱਥੇ ਕੁਝ ਆਮ ਰੁਕਾਵਟਾਂ ਹਨ ਜਿਹਨਾਂ ਦਾ ਡਾਂਸਰ ਸਾਹਮਣਾ ਕਰ ਸਕਦੇ ਹਨ ਸੱਟਾਂ ਨੱਚਣਾ ਸਰੀਰਕ ਤੌਰ 'ਤੇ ਲੋੜੀਂਦਾ ਹੋ ਸਕਦਾ ਹੈ ਅਤੇ ਸੱਟਾਂ ਤਰੱਕੀ ਅਤੇ ਪ੍ਰਦਰਸ਼ਨ ਨੂੰ ਰੋਕ ਸਕਦੀਆਂ ਹਨ ਮੁਕਾਬਲਾ ਡਾਂਸ ਉਦਯੋਗ ਬਹੁਤ ਜ਼ਿਆਦਾ ਪ੍ਰਤੀਯੋਗੀ ਹਨ ਜਿਹਨਾਂ ਨਾਲ ਵੱਖਰਾ ਹੋਣਾ ਅਤੇ ਸੁਰੱਖਿਅਤ ਹੋਣਾ ਮੁਸ਼ਕਿਲ ਹੋ ਗਿਆ ਹੈ